ਹੈਲੋ

ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਤੁਸੀਂ ਪੇਰੈਂਟਸ ਮੀਟਿੰਗ ਅਟੈਂਡ ਨਹੀਂ ਕੀਤੀ ਜੀ ਹਾਂਜੀ ਹਾਂਜੀ ਮੈਮ ਮੈਂ ਹੁਣੇ ਤੁਹਾਨੂੰ ਦੱਸਦੀ ਹਾਂ ਜੀ ਜਸਪ੍ਰੀਤ ਦੀ ਪਰਫੋਰਮੈਂਸ ਪਹਿਲਾਂ ਦਾ ਬਹੁਤ ਵਧੀਆ ਸੀਗੀ ਜੀ ਪਿਛਲੀ ਵਾਰ ਮੈਂ ਤੁਹਾਨੂੰ ਦੱਸਿਆ ਜੀ ਮੈਥ ਦੇ ਵਿੱਚ ਥੋੜ੍ਹਾ ਵੀਕ ਸੀ ਇਸ ਵਾਰ ਮੈਥ ਚੋਂ ਜੀ ਪੂਰੇ ਨੰਬਰ ਲਏ ਨੇ ਜਸਪ੍ਰੀਤ ਨੇ ਬਟ ਦੂਜੇ ਸਬਜੈਕਟ ਤੋਂ ਥੋੜ੍ਹਾ ਜਿਹਾ ਡਾਊਨ ਹੋ ਗਿਆ ਜੀ ਹਾਂਜੀ ਮੈਨੂੰ ਲੱਗਦਾ ਜੀ ਉਹ ਮੈਥ ਦੇ ਵਿੱਚ ਹੀ ਜ਼ਿਆਦਾ ਧਿਆਨ ਦੇਣ ਕਰਕੇ ਬਾਕੀ ਸਬਜੈਕਟ ਦੇ ਵਿੱਚ ਵੀਕ ਰਹਿ ਗਿਆ ਸਾਇੰਸ ਦੇ ਵਿੱਚੋਂ ਜੀ ਜਿਵੇਂ ਸੌ ਦੇ ਵਿੱਚੋਂ ਚੌਂਹਠ ਮਾਰਕਸ ਨੇ ਜੀ ਪਹਿਲਾਂ ਸਾਇੰਸ ਦੇ ਵਿੱਚ ਨੱਬੇ ਸੀਗੇ ਹੁਣ ਚੌਹਠ ਅਤੇ ਰਹਿ ਗਿਆ ਜੀ ਅਤੇ ਹੁਣ ਮੈਥ ਦੇ ਵਿੱਚ ਸੌ ਦੇ ਵਿੱਚੋਂ ਪੂਰੇ ਹੰਡਰਡ ਹੀ ਲੈ ਕੇ ਗਿਆ ਜੀ ਸੌ ਪਲੱਸ ਹਾਂਜੀ ਐੱਸ ਐੱਸ ਟੀ ਦੇ ਵਿੱਚੋਂ ਸਿਕਸਟੀ ਮਾਰਕਸ ਨੇ ਵੀ ਸੱਠ ਮਾਰਕਸ ਨੇ ਸੌ ਦੇ ਵਿੱਚੋਂ ਹੀ ਹਾਂਜੀ ਹਿੰਦੀ ਪੰਜਾਬੀ ਦੇ ਵਿੱਚ ਠੀਕ ਹੈ ਪਰ ਇਹਦੇ ਇਸ ਵਾਰ ਸਾਇੰਸ ਐੱਸ ਐੱਸ ਟੀ 'ਚੋਂ ਮਾਰਕਸ ਘੱਟ ਗਏ ਮੈਨੂੰ ਲੱਗਦਾ ਜੇ ਮੈਥ ਦੇ ਵਿੱਚ ਹੀ ਜ਼ਿਆਦਾ ਜ਼ੋਰ ਦੇ ਗਿਆ ਇਹ ਇਸ ਵਾਰ ਹਾਂਜੀ ਹਾਂਜੀ ਕਿਉਂਕਿ ਸਾਰੀ ਇਕੁਅਲੀ ਨੇ ਜੀ ਸਬਜੈਕਟ ਜੇ ਆਪਾਂ ਇੱਕ ਸਬਜੈਕਟ 'ਤੇ ਧਿਆਨ ਦੇਵਾਂਗੇ ਫਿਰ ਬੱਚੇ ਦਾ ਉੱਧਰ ਹੀ ਕੋਂਨਸਟਰੇਟ ਰਹਿੰਦਾ ਬਾਕੀ ਸਭ ਵਧੀਆ ਜੀ ਡਿਸਿਪਲਨਰ ਡਿਸਿਪਲਨ ਦੇ ਵਿੱਚ ਰਹਿੰਦਾ ਬੱਚਾ ਤੁਹਾਡਾ ਬਾਕੀ ਤਾਂ ਓਕੇ ਹੈ ਪਰ ਇਸ ਵਾਰ ਤੁਸੀਂ ਮੈਥ ਦੇ ਵਿੱਚ ਜ਼ਿਆਦਾ ਜ਼ੋਰ ਦੇਣ ਕਰਕੇ ਇਹ ਇਹਦੀ ਪਰਫੋਰਮੈਂਸ ਥੋੜ੍ਹੀ ਜਿਹੀ ਡਾਊਨ ਹੋ ਗਈ ਪਰ ਅੱਗੇ ਅੱਗੇ ਸਾਰਿਆਂ ਦੇ ਵਿੱਚ ਇਕੁਅਲੀ ਕੋਂਨਸਟਰੇਸ਼ਨ ਨਾਲ ਪੜ੍ਹਦਾ ਤਾਂ ਮੈਨੂੰ ਲੱਗਦਾ ਇਹ ਫਸਟ ਵੀ ਪੋਜੀਸ਼ਨ ਆ ਸਕਦੀ ਹੈ ਨੈਕਸਟ ਟਾਈਮ ਇਹਦੀ ਕਲਾਸ ਦੇ ਵਿੱਚ ਹਾਂਜੀ ਇਹ ਤੋਂ ਬਿਨਾਂ ਆਪਾਂ ਐਕਸਟਰਾ ਕਰੀਕੁਲਮ ਤੁਸੀਂ ਗੇਮਿੰਗ ਦੇ ਵਿੱਚ ਵੀ ਕਿਉਂਕਿ ਆਪਾਂ ਬੱਚੇ ਨੂੰ ਗੇਮਿੰਗ ਦੇ ਵਿੱਚ ਵੀ ਅੱਗੇ ਲੈ ਕੇ ਜਾਈਏ ਉਹਨੇ ਗੇਮ ਵੀ ਨਹੀਂ ਕੋਈ ਅਟੈਂਡ ਕਰ ਪਾ ਰਿਹਾ ਕਹਿੰਦਾ ਜੀ ਮੈਂ ਐਕਸਟਰਾ ਕਲਾਸਿਜ ਲਗਾਉਂਦਾ ਤਾਂ ਕਰਕੇ ਮੈਂ ਗੇਮ ਦੇ ਵਿੱਚ ਨਹੀਂ ਜਾ ਸਕਦਾ ਮੇਰੇ ਪੇਰੈਂਟਸ ਅਲੋ ਨਹੀਂ ਕਰਦੇ ਜੀ ਜੀ ਬਿਲਕੁਲ ਬੱਚਿਆਂ ਦੇ ਡੈਵਲਪ ਲਈ ਸਭ ਚੀਜ਼ਾਂ ਜ਼ਰੂਰੀ ਨੇ ਜੀ ਗੇਮ ਵੀ ਇੰਪੋਰਟੈਂਟ ਰੋਲ ਅਦਾ ਕਰਦੀ ਆ ਆਪਣਾ

ਬਹੁਤ ਵਧੀਆ ਜੀ ਇਹਦਾ ਕਲਾਸ ਦੇ ਨਾਲ ਡਿਸੀਪਲ 'ਚ ਰਹਿੰਦਾ ਹੈ ਸਾਰਾ ਕੁਛ ਵਧੀਆ ਏ ਇਹਦਾ ਬਸ ਇਹ ਤੁਸੀਂ ਥੋੜ੍ਹਾ ਜਿਹਾ ਜੇ ਹੋਰ ਧਿਆਨ ਦਉਂਗੇ ਅਤੇ ਗੇਮ ਦੇ ਵੱਲ ਵੀ ਜਾਵੇਗਾ ਤਾਂ ਮੈਨੂੰ ਲੱਗਦਾ ਇਹ ਏ ਇਨ ਫਿਊਚਰ ਇਹਦੀ ਪਰਫੋਰਮੈਂਸ ਬਹੁਤ ਵਧੀਆ ਹੋਣ ਵਾਲੀ ਹੈ ਹਾਂਜੀ ਹਾਂਜੀ ਜੀ ਜੀ ਜੀ ਜੀ ਠੀਕ ਹੈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ